ਭਾਰਤ ਵਿੱਚ ਸਿਹਤ ਪ੍ਰਣਾਲੀ ਆਜ਼ਾਦੀ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ ਹੈ ਦੂਜੇ ਦੇਸ਼ਾਂ ਨਾਲੋਂ ਅਸੀਂ ਕਾਫੀ ਪਛੜੇ ਹੋਏ ਹਾਂ ਜੇ ਸਿਹਤ ਪ੍ਰਣਾਲੀ ਦੀ ਗੱਲ ਕਰੀਏ ਅਤੇ ਸਾਡੇ ਹਸਪਤਾਲ ਅਤੇ ਕਲੀਨਿਕ ਦੂਜੇ ਦੇਸ਼ਾਂ ਨਾਲੋਂ ਕਾਫੀ ਪਛੜੇ ਹੋਏ ਹਨ ਅਤੇ ਆਮ ਆਦਮੀ ਨੂੰ ਹਰ ਰੋਜ਼ ਇੱਥੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੰਬੀਆਂ ਕਤਾਰਾਂ ਲੱਗਦੀਆਂ ਹਨ ਡਾਕਟਰਾਂ ਦੀ ਪੂਰੀ ਗਿਣਤੀ ਨਹੀਂ ਹੈ ਡਾਕਟਰਾਂ ਕੋਲ ਲੋੜੀਂਦਾ ਸਮਾਨ ਨਹੀਂ ਹੈ ਅਤੇ ਜੇ ਇਸ ਦੇ ਸੁਧਾਰ ਦੀ ਗੱਲ ਕਰੀਏ ਤਾਂ ਸਿਹਤ ਪ੍ਰਣਾਲੀ ਸਭ ਤੋਂ ਪਹਿਲਾਂ ਗਰੀਬ ਆਦਮੀ ਲਈ ਫ੍ਰੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਇਲਾਜ ਚੰਗੀ ਤਰ੍ਹਾਂ ਕਰਾ ਸਕੇ ਅਤੇ ਹਸਪਤਾਲਾਂ ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹੋਣੀਆਂ ਚਾਹੀਦੀਆਂ ਹਨ ਅਤੇ ਸਿਹਤ ਪ੍ਰਣਾਲੀ ਦਾ ਪ੍ਰਾਈਵੇਟੇਸ਼ਨ ਨਹੀਂ ਹੋਣਾ ਚਾਹੀਦਾ ਇਹ ਸਰਕਾਰੀ ਹੱਥਾਂ ਵਿੱਚ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਲੁੱਟ ਕਸੁੱਟ ਨਾ ਹੋ ਸਕੇ